ਤਕਨਾਲੋਜੀ ਨੇ ਬਿਰਧਾਂ ਅਤੇ ਦ੍ਰਿਸ਼ਟੀਹੀਣਾਂ ਦੀ ਮਦਦ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ ਇਹਨਾਂ ਵਿੱਚੋਂ ਇੱਕ ਹੈ ਬੀ ਮਾਈ ਆਈਜ ਐਪ ਬੀ ਮਾਈ ਆਈਜ ਲਾਈਵ ਵੀਡੀਓ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਦੁਨੀਆ ਵਿੱਚ ਕਿਤੇ ਵੀ ਵੋਲੰਟੀਅਰਾਂ ਅਤੇ ਕੰਪਨੀਆਂ ਨਾਲ ਦ੍ਰਿਸ਼ਟੀਗਤ ਦ੍ਰਿਸ਼ਟੀਹੀਣ ਅਤੇ ਲੋੜਵੰਦ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ ਬੀ ਮਾਈ ਆਈਜ ਵਲੰਟੀਅਰ ਬਣ ਕੇ ਤੁਸੀਂ ਲੋਕਾਂ ਨੂੰ ਸਮਰਥਨ ਕਰ ਸਕਦੇ ਹੋ ਜੋ ਅੰਨ੍ਹੇ ਹਨ ਜਾਂ ਘੱਟ ਨਜ਼ਰ ਵਾਲੇ ਹਨ ਜਦੋਂ ਉਹਨਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ